ਲਿੰਗ ਸਮਾਨਤਾ ਅਤੇ ਖੇਡਾਂ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਰੂਪ ਵਿੱਚ ਸ਼ਾਮਿਲ ਕਰਨ ਲਈ ਵੀ ਸਾਡੇ ਖੇਤਰ 'ਚ ਜਿਹੜੀਆਂ ਨੀਤੀਆਂ ਚੱਲਦੀਆਂ ਉਹਦੇ ਵਿੱਚ ਇਹ ਆ ਕਿ ਪਹਿਲਾਂ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਖੇਡਾਂ ਖੇਡਦੇ ਸੀ ਜਿਵੇਂ ਕਿ ਕਬੱਡੀ ਲਾ ਲਓ ਤੈਰਾਕੀ ਲਾ ਲਓ ਗੋਤਾਖੋਰੀ ਲਾ ਲਓ ਜਿੰਨੀਆਂ ਵੀ ਸਾਡੀਆਂ ਖੇਡਾਂ ਸੀ ਸਾਰੇ ਮੁੰਡੇ ਖੇਡਦੇ ਸੀ ਪਰ ਹੁਣ ਲਿੰਗ ਸਮਾਨਤਾ 'ਚ ਬਰਾਬਰਤਾ ਦੇਣ ਲਈ ਵੀ ਜਿਹੜੀਆਂ ਨੀਤੀਆਂ ਚਲਾਈਆਂ ਗਈਆਂ ਉਹ ਉਹ ਵੀ ਜਿਹੜੀਆਂ ਕੁੜੀਆਂ ਕੁੜੀਆਂ ਨੂੰ ਵੀ ਅੱਗੇ ਆਉਣ ਲਈ ਨੀਤੀਆਂ ਚਲਾਈਆਂ ਗਈਆਂ ਵੀ ਕੁੜੀਆਂ ਵੀ ਖੇਡਾਂ ਦੇ ਵਿੱਚ ਅੱਗੇ ਆਉਣ ਜਿਹਦੇ ਵਿੱਚ ਵੀ ਜਿਵੇਂ ਕਿ ਜਿਹੜਾ ਮੈ ਜਿਹੜਾ ਇਨਾਮ ਮੈਡਲ ਮੁੰਡੇ ਨੂੰ ਮਿਲਣਾ ਉਹੀ ਇਨਾਮ ਕੁੜੀ ਨੂੰ ਦਿੱਤਾ ਜਾਊਗਾ ਜਿਹਦੇ ਵਿੱਚ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਵੀ ਕਹਿ ਕੇ ਗਏ ਆ ਵੀ ਬੇਟੀ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਅਤੇ ਇੱਕ ਜਿਵੇਂ ਬੇਟੀ ਪੜ੍ਹਾਉ ਬੇਟੀ ਬਚਾਓ ਸਿੱਖਿਆ ਦਿੱਤੀ ਗਈ ਆਪਾਂ ਨੂੰ ਵੀ ਇਹਦੇ ਵਿੱਚ ਵੀ ਬੇਟੀਆਂ ਪੜ੍ਹਨਗੀਆਂ ਖੇਡਾਂ 'ਚ ਆਉਣਗੀਆਂ ਅੱਗੇ ਆਉਣਗੀਆਂ ਵੀ ਜਿਹੜੀ ਸਾਡੇ 'ਚ ਲਿੰਗ ਸਮਾਨਤਾ ਉਹ ਬਰਾਬਰ ਦੀਆਂ ਹਿੱਸੇਦਾਰ ਹੋਣਗੀਆਂ ਅਤੇ ਉਹ ਉਹਦੀ ਬਰਾਬਰਤਾ ਸਾਡੇ 'ਚ ਵਧੇਗੀ ਵੀ ਇਹਦੇ 'ਚ ਪਾੜਾ ਨਹੀਂ ਪਊਗਾ ਕਿ ਮੁੰਡਿਆਂ ਨੂੰ ਪਹਿਲ ਜਾਂ ਕੁੜੀਆਂ ਨੂੰ ਪਹਿਲ ਵੀ ਇਹਦੇ ਨਾਲ ਜਿਹੜੀ ਲਿੰਗ ਸਮਾਨਤਾ ਜਿਵੇਂ ਕਿ ਚਾਰ ਕੁੜੀਆਂ ਕਿਸੇ ਖੇਡ ਦੇ ਵਿੱਚ ਆ ਅਤੇ ਚਾਰ ਹੀ ਮੁੰਡੇ ਉਸ ਖੇਡ ਦੇ ਵਿੱਚ ਆ ਹਾਲਾਂਕਿ ਪਹਿਲਾਂ ਇਹ ਹੁੰਦਾ ਸੀ ਕਿ ਇੱਕ ਮੁੰਡਾ ਕਿਸੇ ਖੇਡ 'ਚ ਹੁੰਦਾ ਸੀ ਅਤੇ ਕੁੜੀ ਇੱਕ ਵੀ ਨਹੀਂ ਹੁੰਦੀ ਸੀ ਦਸ ਮੁੰਡੇ ਕਿਸੇ ਖੇਡ 'ਚ ਹੁੰਦੇ ਸੀ ਕੁੜੀਆਂ ਦੋ ਹੀ ਹੁੰਦੀਆਂ ਸੀ ਵੀ ਕੁੜੀਆਂ ਨੂੰ ਤਾਂ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ ਖੇਡਾਂ 'ਚ ਤਾਂ ਆਉਣ ਦੀ ਉਹਨਾਂ ਲਈ ਬਹੁਤ ਦੂਰ ਦੀ ਗੱਲ ਸੀ ਪਰ ਹੁਣ ਇਹ ਵੀ ਅਲੱਗ ਅਲੱਗ ਜਗ੍ਹਾ 'ਤੇ ਨੀਤੀਆਂ ਚਲਾਈਆਂ ਜਾਂਦੀਆਂ ਜਿਹਦੇ ਵਿੱਚ ਕੁੜੀਆਂ ਨੂੰ ਸਕੂਲਾਂ ਦੇ ਪੱਧਰ 'ਤੇ ਹੀ ਖੇਡਾਂ ਵਾਲਾ ਇੱਕ ਸਬਜੈਕਟ ਹੁੰਦਾ ਫਿਜੀਕਲ ਐਜੂਕੇਸ਼ਨ ਅਤੇ ਕੋਲਜ ਪੱਧਰ 'ਤੇ ਵੀ ਖੇਡਾਂ ਹੁੰਦੀਆਂ ਅਤੇ ਅੱਗੇ ਯੂਨੀਵਰਸਿਟੀ ਪੱਧਰ 'ਤੇ ਵੀ ਖੇਡਾਂ ਹੁੰਦੀਆਂ ਅਤੇ ਮੁਕਾਬਲੇ ਕਰਵਾਏ ਜਾਂਦੇ ਆ ਜਿਹਦੇ ਵਿੱਚ ਅੱਜ ਮੁੰਡਿਆਂ ਦੇ ਨਾਲੋਂ ਜ਼ਿਆਦਾ ਇਨਾਮ ਕੁੜੀਆਂ ਪ੍ਰਾਪਤ ਕਰਦੀਆਂ ਅਤੇ ਇਹਦੇ ਅਨੁਸਾਰ ਜਿਹੜਾ ਲਿੰਗ ਅਨੁਪਾਤ ਦਾ ਉਹ ਪਾੜਾ ਘੱਟਦਾ